ਆਪਣੀ ਸ਼ੋਟਾਂ ਦੀ ਰਚਨਾ ਮੈਂ ਪ੍ਰਾਕਿਰਤਿਕ ਰੂਪ ਦੇ ਵਿੱਚ ਕਰਨਾ ਜ਼ਿਆਦਾ ਪਸੰਦ ਕਰਦੀ ਹਾਂ ਜਿੱਦਾਂ ਤੁਸੀਂ ਕਿਸੇ ਬਾਗ ਦੇ ਵਿੱਚ ਚਲ ਜਾਂਦੇ ਹੋ ਆਸੇ ਪਾਸੇ ਫੁੱਲ ਪੇੜ ਪੌਦੇ ਹਰਿਆਲੀ ਇੱਦਾਂ ਦੇ ਸ਼ੋਟ ਬਣਾਉਣ ਦੇ ਵਿੱਚ ਬੜਾ ਹੀ ਵਧੀਆ ਲੱਗਦਾ ਹੈ ਜਿੱਦਾਂ ਕਿ ਤੁਸੀਂ ਧਾਰਮਿਕ ਸਥਾਨ ਦੀ ਵੀ ਸ਼ੋਟਸ ਬਣਾ ਸਕਦੇ ਹੋ ਜਿਵੇਂ ਕਿ ਕੋਈ ਮੰਦਰ ਦੇ ਵਿੱਚ ਅੱਜ ਕੱਲ੍ਹ ਤਾਂ ਬਹੁਤ ਪੂਜਾ ਚੱਲਦੀਆਂ ਰਹਿੰਦੀਆਂ ਆਰਤੀ ਦਾ ਸਮੇਂ ਹੁੰਦਾ ਕਿੱਦਾਂ ਪੰਡਿਤ ਆਰਤੀ ਕਰਦੇ ਹੈ ਕਿੱਦਾਂ ਲੋਕ ਇਹਦੇ ਵਿੱਚ ਭਾਗ ਲੈਗੈ ਲੈਂਦੇ ਹੈ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੇ ਸ਼ਾਰਟ ਤਿਆਰ ਕਰ ਸਕਦੇ ਹਾਂ ਇਹਦੇ ਨਾਲ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਪ੍ਰਾਕਿਰਤਿਕ ਤੌਰ 'ਤੇ ਜ਼ਿਆਦਾ ਤੋਂ ਜ਼ਿਆਦਾ ਸ਼ਾਰਟ ਲਿੱਤੇ ਜਾਣ ਉੱਥੇ ਨਜ਼ਾਰੇ ਦੇਖਣ ਵਾਲੇ ਹੁੰਦੇ ਹੈ ਸ਼ਾਮ ਦਾ ਸਮੇਂ ਬਹੁਤ ਅੱਛਾ ਲੱਗਦਾ ਜਦੋਂ ਸੂਰਜ ਅੰਦਰ ਬਾਹਰ ਹੁੰਦਾ ਇਹ ਟਾਈਮ ਸ਼ੋਰਟਸ ਬਣਾਉਣ ਲਈ ਬਹੁਤ ਹੀ ਵਧੀਆ ਟਾਈਮ ਹੁੰਦਾ ਹੈ ਜਾਂ ਤੁਸੀਂ ਸਵੇਰੇ ਸਵੇਰੇ ਜਦੋਂ ਸੂਰਜ ਉੱਗਦਾ ਹੁੰਦਾ ਉਹਦੇ ਨਜ਼ਾਰਿਆ ਦੇ ਨਾਲ ਸ਼ਾਰਟਸ ਲੈ ਸਕਦੇ ਹੋ ਇਸ ਕਰਕੇ ਸਾਡਾ ਇਹ ਦਿਨ ਦੀ ਸ਼ੁਰੂਆਤ ਵੀ ਬਹੁਤ ਵਧੀਆ ਹੋ ਜਾਂਦੀ ਹੈ ਅਤੇ ਸਾਡਾ ਮਨੋਰੰਜਨ ਦਾ ਮਨੋਰੰਜਨ ਹੋ ਜਾਂਦਾ ਅਤੇ ਸਾਡੇ ਸ਼ਾਰਟ ਦਾ ਸ਼ਾਰਟ ਹੋ ਜਾਂਦਾ ਇਸ ਕਰਕੇ ਜਿਹੜੇ ਸ਼ਾਰਟ ਲਿੱਤੇ ਜਾਂਦੇ ਹੋ ਉਹ ਤਕਨੀਕੀ ਜਾਂ ਰਣਨੀਤੀ ਅਸੀਂ ਕਿਸੇ ਨੂੰ ਅਸੀਂ ਕਹਿ ਕੇ ਅਸੀਂ ਫੋਟੋ ਖਿਚਵਾ ਸਕਦੇ ਹਾਂ ਜਾਂ ਅਸੀਂ ਆਪ ਹੀ ਇਹ ਰੀ ਇਹਦੀ ਸ਼ੋਟਸ ਬਣਾ ਸਕਦੇ ਹਾਂ ਇਹ ਸਾਨੂੰ ਬਹੁਤ ਹੀ ਵਧੀਆ ਲੱਗਦਾ ਲੁਭਾਵਣਾ ਹੁੰਦਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਾਡਾ ਬਹੁਤ ਵਧੀਆ ਉਪਚਾਰਿਕ ਤਰੀਕਾ ਵੀ ਹੈ ਇਸ ਕਰਕੇ ਸ਼ਾਰਟ ਦੀ ਰਚਨਾ ਕਰਨ ਦਾ ਫੈਸਲਾ ਮੈਂ ਬਹੁਤ ਹੀ ਵਧੀਆ ਤਰੀਕੇ ਰਣਨੀਤੀ ਨਾਲ ਅੱਛੇ ਤਰੀਕੇ ਦੇ ਨਾਲ ਅਪਣਾਉਂਦੀ ਹਾਂ